ਆਨਲਾਈਨ ਠੱਗੀਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਕਈ ਵਾਰ ਕਿਸੇ ਲਿੰਕ ਉੱਪਰ ਕਲਿੱਕ ਕਰਨ ਦੀ ਆਪਣੇ ਖਾਤੇ ਵਿੱਚੋਂ ਪੈਸੇ ਕੱਟੇ ਜਾ ਸਕਦੇ ਹਨ ਜਾਂ ਕਈ ਵਾਰ ਕੋਈ ਓ ਟੀ ਪੀ ਜਾਂ ਆਪਣਾ ਬੈਂਕ ਖਾਤਾ ਕੋਲ ਦੁਆਰਾ ਆਪਣੇ ਤੋਂ ਮੰਗਾਇਆ ਜਾਂਦਾ ਹੈ ਅਤੇ ਆਪਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਬੀਮਾ ਜਾਂ ਕੋਈ ਪੋਲਿਸੀ ਸ਼ੁਰੂ ਕੀਤੀ ਹੈ ਇਸ ਲਈ ਤੁਸੀਂ ਆਪਣਾ ਖਾਤਾ ਨੰਬਰ ਜਾਂ ਫੋਨ ਨੰਬਰ ਆਧਾਰ ਕਾਰਡ ਸਾਨੂੰ ਦੱਸ ਦਿਓ ਅਤੇ ਤੁਹਾਡਾ ਇਹ ਲਾਗੂ ਹੋ ਜਾਵੇਗਾ ਅਤੇ ਹੋਰ ਤਰ੍ਹਾਂ ਜਿੱਦਾਂ ਆਪਾਂ ਕੋਈ ਸਮਾਨ ਕਿਸੇ ਸਾਈਡ ਤੋਂ ਮੰਗਵਾ ਲੈਂਦੇ ਹਾਂ ਉਹਨਾਂ ਵਿੱਚ ਵੀ ਠੱਗੀ ਵੱਧ ਜਾਂਦੀ ਹੈ ਜਿਵੇਂ ਉਹ ਪੈਸੇ ਪਹਿਲਾਂ ਮੰਗਵਾ ਲੈਂਦੇ ਹਨ ਅਤੇ ਸਮਾਨ ਬਾਅਦ ਦੇ ਵਿੱਚ ਘਰ ਡਿਲੀਵਰ ਕਰਦੇ ਹਨ ਮੇਰੇ ਨਾਲ ਵੀ ਇੱਕ ਵਾਰ ਅਜਿਹਾ ਹੋਇਆ ਸੀ ਕਿ ਮੈਂ ਇੱਕ ਸਾਈਡ ਤੋਂ ਦੇਖ ਕੇ ਸੂਟ ਦੇਖ ਲੈਤੇ ਅਤੇ ਉਹ ਬਾਅਦ ਵਿੱਚ ਮੈਂ ਆਰਡਰ ਕਰ ਦਿੱਤੇ ਅਤੇ ਮੈਂ ਪੈਸੇ ਉਹਦੀ ਜਮਾਂ ਕਰਾ ਦਿੱਤੀ ਅਤੇ ਜਦ ਉਹ ਪਾਰਸਲ ਮੇਰੀ ਘਰ ਆਇਆ ਤਾਂ ਉਸਦੇ ਵਿੱਚ ਸਿਰਫ ਲੀਰਾ ਸਨ ਨਾ ਕਿ ਕੋਈ ਸੂਟ ਸੀ ਮੇਰੇ ਨਾਲ ਵੀ ਇਸ ਇਸ ਤਰਾਂ ਆਨਲਾਈਨ ਠੱਗੀ ਹੋਈ ਸੀ